ਹੈਲੋ ਹਾਂਜੀ ਗੁਡ ਈਵਨਿੰਗ ਯੈਸ ਮੈਮ ਹਾਂ ਮੈਂ ਇਹ ਸੋਚ ਰਿਹਾ ਸੀਗਾ ਅਤੇ ਬੱਚਿਆਂ ਨੂੰ ਬੈਗ ਲੈ ਕੇ ਆਉਣੇ ਪੈਂਦੇ ਇੰਨੇ ਭਾਰੇ ਭਾਰੇ ਬਿਨਾਂ ਗੱਲ ਮੈਨੂੰ ਤਾਂ ਐ ਲੱਗਦਾ ਕਈ ਵਾਰੀ ਕਿ ਬਿਨਾਂ ਗੱਲ ਤੋਂ ਲਿਆਉਣੇ ਪੈ ਰਹੇ ਆ ਅਤੇ ਇਹ ਜਿਹੜਾ ਐਡਾ ਵੱਡਾ ਬੈਗ ਦਾ ਬੋਝ ਹੈ ਇਹ ਕੀ ਕੋਈ ਇਸ ਤਰ੍ਹਾਂ ਦਾ ਮੈਂ ਫਾਰਮੂਲਾ ਸੋਚਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਵੀ ਜਿਹਦੇ ਨਾਲ ਉਹਨਾਂ ਦੇ ਜਿਹੜੇ ਬੈਗ ਨੇ ਅਤੇ ਹਟਾ ਦਿੱਤੇ ਜਾਣ ਅਤੇ ਉਹ ਬਿਨਾਂ ਬੈਗ ਤੋਂ ਆਉਣ ਅਤੇ ਜੋ ਵੀ ਹੈ ਉੱਥੇ ਜਿਹਨਾਂ ਨੇ ਇੱਥੇ ਪੜ੍ਹਨਾ ਆ ਕੇ ਇੱਥੇ ਆਪਾਂ ਬੁਕਸ ਆਪਾਂ ਇਹਦੇ 'ਚ ਕੀ ਕਰ ਸਕਦੇ ਤੁਹਾਨੂੰ ਕੀ ਲੱਗਦਾ ਕੀ ਇਹ ਪੋਸੀਬਲ ਹੈ ਕਿ ਨਹੀਂ ਹੈ ਇਸ ਪੋਲਿਸੀ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਤੁਹਾਨੂੰ ਕੀ ਮਹਿਸੂਸ ਹੁੰਦਾ ਤੁਹਾਡੀ ਐਕਟੀਵਿਟੀ ਦੇ ਰਾਹੀਂ ਤੁਸੀਂ ਆਪਾਂ ਕਿਵੇਂ ਫਿਰ ਬੱਚਿਆਂ ਨੂੰ ਨੋਲੇਜ ਦੇ ਪਾਵਾਂਗੇ ਇਜ ਇਟ ਪੋਸੀਬਲ ਹਾਂ ਇਸੇ ਹੀ ਜੀ ਜੀ

ਸਹੀ ਗੱਲ ਠੀਕ ਹੈ ਪਰ ਮੈਨੂੰ ਆਹ ਜਿਹੜਾ ਤੁਸੀਂ ਇਹ ਗੱਲ ਕਹੀ ਹੈ ਕਿ ਟੀਚਰ ਉਹਨਾਂ ਨੂੰ ਹੋਮਵਰਕ ਦੇਣ ਅਤੇ ਉਹ ਇੰਨਾ ਕੁ ਹੋਵੇ ਕਿ ਘੰਟੇ ਕੁ ਦੇ ਵਿੱਚ ਅਗਰ ਹੋ ਜਾਏ ਤਾਂ ਕਿਉਂਕਿ ਇਹ ਸਬਜੈਕਟ ਕਾਫੀ ਹੁੰਦੇ ਆ ਔਰ ਸਾਰੇ ਜਿਵੇਂ ਆਪਣੇ ਕੋਲ ਪੰਜ ਆਪਾਂ ਪੰਜ ਛੇ ਸਬਜੈਕਟ ਵੀ ਪੜ੍ਹੀਏ ਹੈ ਨਾ ਚਾਰ ਪੰਜ ਵੀ ਤਾਂ ਵਿੱਚ ਕਈ ਲਰਨਿੰਗ ਪ੍ਰੋਸੈਸਿਸ ਨੇ ਕੁਛ ਹੋਰ ਨੇ ਤਾਂ ਇੱਕ ਅੱਧੀ ਉਹ ਚੀਜ਼ ਇੱਕ ਫਾਈਲ ਉਹਨਾਂ ਕੋਲ ਜ਼ਰੂਰ ਹੋਣੀ ਚਾਹੀਦੀ ਜਿਹਦੇ 'ਚ ਅਗਰ ਉਹਨਾਂ ਨੇ ਕੁਛ ਲਰਨ ਕਰਨਾ ਹੈ ਤਾਂ ਮੇਰਾ ਖਿਆਲ ਹੈ ਕਿ ਉਹ ਆਪਦੇ ਘਰ ਜਾ ਕੇ ਲਰਨ ਕਰ ਸਕਣ ਉਹ ਮਟੀਰੀਅਲ ਉੱਥੋਂ ਲੈ ਜਾਣ ਲਰਨ ਕਰਨ ਵਾਲਾ ਔਰ ਇਸਦੇ ਬਾਵਜੂਦ ਹਾਂ ਠੀਕ ਹੈ ਇਹ ਵੀ ਗੱਲ ਠੀਕ ਹੈ ਪਰ ਜੇ ਆਪਾਂ ਦੇਖੀਏ ਇੱਦਾਂ ਬੱਚੇ ਦੇ ਕੋਲ ਕਿਉਂਕਿ ਉਹਦੀ ਡਿਵਲਪਮੈਂਟ ਦਾ ਟਾਈਮ ਇਹੀ ਹੈ ਚੌਵੀ ਘੰਟੇ ਨੇ ਉਹਦੇ ਕੋਲ ਆਹ ਤਾਂ ਇਸ ਕਰਕੇ ਅਗਰ ਅਸੀਂ ਇਹ ਕੰਮ ਕਰ ਸਕੀਏ ਇੱਕ ਹੋਰ ਅਤੇ ਬੱਚਿਆਂ ਨੂੰ ਜਿਹੜੀਆਂ ਉਹਨਾਂ ਦੀਆਂ ਹੋਮਵਰਕ ਦੀਆਂ ਜਿਹੜੀਆਂ ਉਹਨਾਂ ਦੀਆਂ ਰਾਈਟਿੰਗ ਦੇ ਸੀਟਸ ਨੇ ਯਾਨੀ ਕਿ ਉਹ ਫਾਈਲ ਟਾਈਪ ਦੀਆਂ ਹੋਣ ਹੈ ਨਾ ਅਤੇ ਬਾਕੀ ਉਹਨਾਂ ਨੂੰ ਮੈਕਸੀਮਮ ਟਾਈਮ ਦੇਣ ਲਈ ਅਗਰ ਅਸੀਂ ਇਸ ਨੂੰ ਫੁੱਲ ਡੇ ਸਿਸਟਮ ਵੀ ਬਣਾ ਦਈਏ ਅਤੇ ਮੈਨੂੰ ਲੱਗਦਾ ਉਹ ਵੀ ਬੈਟਰ ਰਹੇਗਾ ਬਾਕੀ ਠੀਕ ਹੈ ਆਪਾਂ ਹੋਰ ਵੀ ਗੱਲਾਂ ਕਰਦੇ ਹਾਂ ਪਰ ਅੱਜ ਮੈਨੂੰ ਲੱਗਦਾ ਅੱਜ ਨਹੀਂ ਫਿਰ ਆਪਾਂ ਫਿਰ ਤੁਸੀਂ ਸੋਚ ਲਓ ਚੰਗੀ ਤਰ੍ਹਾਂ ਇਸ ਟੋਪਿਕ ਦੇ ਉੱਤੇ ਆਪਾਂ ਫਿਰ ਕੱਲ੍ਹ ਨੂੰ ਗੱਲ ਕਰ ਲਵਾਂਗੇ ਇਹਦੇ ਬਾਰੇ ਹਾਂ ਹਾਂ ਠੀਕ ਹੈ ਤੁਸੀਂ ਵੀ ਸੋਚ ਕੇ ਆਇਓ ਜੀ ਬਾਕੀ ਸਾਰੇ ਵੀ ਸੋਚ ਕੇ ਆਉਣ ਓਕੇ ਓਕੇ